ਮੈਨੂੰ ਕਾਫੀ ਤਰ੍ਹਾਂ ਦੀਆਂ ਮੱਛੀਆਂ ਪਸੰਦ ਨੇ ਕ ਜਿਵੇਂ ਕਿ ਗੱਲ ਕਰ ਲਈਏ ਅਲੱਗ ਅਲੱਗ ਕਿਸਮਾਂ ਦੀ ਜਿਵੇਂ ਕਿ ਕਰੈਬ ਸਪੈਨਰ ਹਾਈਬ੍ਰਿਡ ਗੁਲਾਬੀ ਚਿੰਗਾ ਇਹ ਕਿ ਮੱਛੀਆਂ ਦੀ ਅਲੱਗ ਅਲੱਗ ਕਿਸਮ ਪਾਈ ਜਾਂਦੀ ਹੈ ਮੈਂ ਮੱਛੀ ਖਾਣ 'ਚ ਇੰਟਰਸਟ ਨਹੀਂ ਰੱਖਦਾ ਪਰ ਦੇਖਿਆ ਜਾਵੇ ਕਈ ਲੋਕ ਮੱਛੀ ਖਾਣਾ ਬਹੁਤ ਪਸੰਦ ਕਰਦੇ ਹਨ ਜਿਵੇਂ ਕਿ ਗੱਲ ਕਰ ਲਈਏ ਖਾਣੇ ਵਿੱਚ ਜ਼ਿਆਦਾਤਰ ਗਾਨਾ ਸੰਘਾੜਾ ਵਾਸਾ ਕਿਸਮ ਦੀ ਮ ਮੱਛੀ ਨੂੰ ਪਹਿਲ ਦਿੰਦੇ ਨੇ ਉਹ ਗੱਲ ਕਰ ਲਈਏ ਕਿਉਂਕਿ ਖਾਣੇ ਵਿੱਚ ਦੱਸਦੇ ਨੇ ਕਿ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਅਤੇ ਕਈ ਲੋਕ ਮ ਲੋ ਡਾਕਟਰ ਦੀ ਮਦਦ ਸਲਾਹ ਦੇ ਨਾਲ ਇਸ ਨੂੰ ਖਾਣ ਲਈ ਪਰੈਫਰ ਕਰਦੇ ਨੇ